ਫਿਲਮਾਂ ਦੀ ਦੁਨੀਆਂ ਨੇ ਭਾਰਤ ਦੇ ਵਿੱਚ ਫੈਸ਼ਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਅੱਜ ਕੱਲ੍ਹ ਆਮ ਹੀ ਦੇਖਿਆ ਜਾਂਦਾ ਹੈ ਕਿ ਜਿਹੜੇ ਅਦਾਕਾਰ ਹੁੰਦੇ ਹਨ ਉਹ ਵੱਖੋ ਵੱਖਰੇ ਤਰ੍ਹਾਂ ਦੇ ਕੱਪੜੇ ਪਹਿਨਦੇ ਹਨ ਇਹ ਜਿਹੜੇ ਕੱਪੜੇ ਹਨ ਉਹ ਸੱਭਿਆਚਾਰਕ ਵੀ ਹੁੰਦੇ ਹਨ ਕੁਛ ਪੁਰਾਣੇ ਜਮਾਨੇ ਦੇ ਕੱਪੜੇ ਵੀ ਹੁੰਦੇ ਹਨ ਅਤੇ ਕੁਝ ਵੈਸਟਰਨ ਟਾਈਪ ਕੱਪੜੇ ਵੀ ਹੁੰਦੇ ਹਨ ਜਿਹੜੇ ਕਿ ਲੋਕ ਬਾਹਰਲੇ ਦੇਸ਼ਾਂ ਤੋਂ ਕਾਪੀ ਕਰਦੇ ਹਨ ਅਤੇ ਉਹਨਾਂ ਨੂੰ ਦੇਖ ਕੇ ਅਜਿਹੀਆਂ ਡਰੈਸ ਬਣਾਉਂਦੇ ਹਨ ਲੋਕ ਇਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਅਤੇ ਜਿਹੜੇ ਲੋਕ ਹਨ ਉਹ ਆਪਣੇ ਫੇਮਸ ਜਿਹੜੇ ਅਦਾਕਾਰ ਹੁੰਦੇ ਹਨ ਉਹਨਾਂ ਨੂੰ ਦੇਖ ਕੇ ਆਪਣਾ ਸਟਾਈਲ ਚੇਂਜ ਕਰਦੇ ਹਨ ਅਤੇ ਉਹਨਾਂ ਦੇ ਤਰ੍ਹਾਂ ਬਣਨ ਦੀ ਕੋਸ਼ਿਸ਼ ਕਰਦੇ ਹਨ ਜਿਹਦੇ ਕਰਕੇ ਜਿਹੜੇ ਫੈਸ਼ਨ ਦੇ ਜਿਹੜੇ ਰੁਝਾਨ ਨੇ ਉਹ ਬਦਲਦੇ ਰਹਿੰਦੇ ਹਨ ਅਤੇ ਅਜਿਹੇ ਕਈ ਪਾਤਰਾਂ ਵਿੱਚ ਦੇਖਿਆ ਗਿਆ ਹੈ ਜਿਵੇਂ ਕਿ ਪੰਜਾਬੀ ਫਿਲਮਾਂ ਦੇ ਵਿੱਚ ਦਲਜੀਤ ਦੋਸਾਂਝ ਵਰਗੇ ਅਜਿਹੇ ਪਾਤਰ ਹਨ ਜਿਨਾਂ ਦੇ ਫਿਲਮਾਂ ਦੇ ਵਿੱਚ ਬਾਹਰਲੇ ਦੇਸ਼ਾਂ ਵਾਲੇ ਕੱਪੜੇ ਵੀ ਪਾਏ ਹੁੰਦੇ ਹਨ ਮਹਿੰਗੇ ਅਤੇ ਉਹ ਇੱਥੇ ਭਾਰਤ ਦੇ ਵਿੱਚ ਬਣੇ ਪੰਜਾਬੀ ਪਹਿਰਾਵੇ ਅਤੇ ਹੋਰ ਦੇਸੀ ਕੱਪੜੇ ਵੀ ਪਹਿਨਦੇ ਹਨ ਜਿਨ੍ਹਾਂ ਨੂੰ ਦੇਖ ਕੇ ਬਹੁਤ ਲੋਕ ਪ੍ਰਭਾਵਿਤ ਹੁੰਦੇ ਹਨ ਅਤੇ ਉਹਨਾਂ ਵਰਗੇ ਕੱਪੜੇ ਪਹਿਨਣ ਦੀ ਕੋਸ਼ਿਸ਼ ਕਰਦੇ ਹਨ